ਪੰਜਾਬ ਵਿੱਚ ਵਪਾਰਕ ਖੇਤਰ ਸਥਾਨਕ ਭਾਈਚਾਰੇ ਨਾਲ ਕਾਫੀ ਜੁੜੀਆਂ ਹੋਈਆਂ ਹਨ ਇਸ ਨਾਲ ਲੋਕਾਂ ਨੂੰ ਸਿੱਖਿਆ ਦੇ ਮੌਕੇ ਵੀ ਮਿਲਦੇ ਹਨ ਕਿਉਂਕਿ ਉਹ ਵਪਾਰ ਦੇ ਖੇਤਰ ਵਿੱਚ ਨਵੇਂ ਹੁਨਰ ਅਤੇ ਗਿਆਨ ਪ੍ਰਾਪਤ ਕਰਦੇ ਹਨ ਹਾਲਾਂਕਿ ਇਨਫਰਾਸਟਰਕਚਰ ਦੀ ਘਾਟ ਹੋਣ ਕਾਰਨ ਕਈ ਵਾਰ ਵਪਾਰਕ ਖੇਤਰ ਨੂੰ ਪੂਰੀ ਤਰ੍ਹਾਂ ਤਰੱਕੀ ਕਰਨ ਵਿੱਚ ਰੁਕਾਵਟ ਆਉਂਦੀ ਹੈ ਪਰ ਇਹ ਭਾਈਚਾਰੇ ਵਿੱਚ ਵਧੀਆ ਕੁਝ ਮੌਕੇ ਉਤਪੰਨ ਕਰਦਾ ਹੈ ਉਦਾਹਰਣ ਵਜੋਂ ਜਦੋਂ ਨਵੇਂ ਬਿਜਨਸ ਆਉਂਦੇ ਹਨ ਤਾਂ ਉਹ ਸਥਾਨਕ ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਸਥਾਨਕ ਵਿਕਾਸ ਅਤੇ ਯੋਗਦਾਨ ਪਾਉਂਦੇ ਹਨ ਇਸ ਤਰ੍ਹਾਂ ਵਪਾਰਕ ਖੇਤਰ ਸਥਾਨਕ ਭਾਈਚਾਰੇ ਵਿੱਚ ਬਿਹਤਰ ਮੌਕੇ ਨੌਕਰੀ ਅਤੇ ਸਮਾਜਿਕ ਉੱਨਤੀ ਲਈ ਖੁੱਲ੍ਹਾ ਰਾਹ ਦਿੰਦੇ ਹਨ